ਹੈਲੋ ਸਰ ਮਾਨ ਟਰੈਵਲ ਤੋਂ ਗੱਲ ਕਰ ਰਹੇ ਬਠਿੰਡੇ ਤੋਂ ਸੰਦੀਪ ਗੱਲ ਕਰ ਰਿਹਾ ਜੀ ਝੁੰਬੇ ਪਿੰਡ ਤੋਂ ਸਰ ਸਾਨੂੰ ਨਾ ਇੱਕ ਤੁਹਾਡੀ ਗੱਡੀ ਚਾਹੀਦੀ ਹੈ ਕੈਬ ਅਸੀਂ ਟੂਰ ਦੇ ਲਈ ਪਰਿਵਾਰ ਦੇ ਨਾਲ ਨਾ ਹਿਮਾਚਲ ਜਾਣਾ ਮੈਕਲੋਡਗੰਜ ਘੁੰਮਣ ਦੇ ਲਈ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਅਤੇ ਇਸ ਕਰਕੇ ਅਸੀ ਸਾਰੇ ਪਰਿਵਾਰ ਨੇ ਜਾਣਾ ਹੈ ਨਾ ਜੀ ਅਤੇ ਹਾਂਜੀ ਹਾਂਜੀ ਸਰ ਸਾਨੂੰ ਇਨੋਵਾ ਗੱਡੀ ਚਾਹੀਦੀ ਹੈ ਤੁਹਾਡੀ ਅਤੇ ਆਪਣਾ ਕੀ ਪ੍ਰਾਈਜ਼ ਹੋਊਗਾ ਜੀ ਉਹਦਾ ਸਾਡੇ ਨਾਲ ਕਿਲੋਮੀਟਰ ਦੇ ਹਿਸਾਬ ਨਾਲ ਕਰੋਗੇ ਜਾਂ ਕਿਵੇਂ ਹੈ ਨਾ ਜੀ ਬਾਕੀ ਤੇਲ ਤੁਹਾਡਾ ਆਪਣਾ ਹੀ ਹੋਊਗਾ ਜੀ ਹਾਂ ਬਾਕੀ ਕੋਈ ਨਾ ਜੀ ਤੁਸੀਂ ਦੇਖ ਲਿਓ ਅਤੇ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਵੀ ਕਿਉਂਕਿ ਸਾਨੂੰ ਹੋਰ ਗੱਡੀ ਦਾ ਵੀ ਅਸੀਂ ਇੱਕ ਫੋਨ ਕਰਿਆ ਸੀ ਉਹ ਥੋੜ੍ਹਾ ਜਿਹਾ ਤੁਹਾਡੇ ਨਾਲੋਂ ਘੱਟ ਕਹਿ ਰਹੇ ਸੀਗੇ ਅਤੇ ਹਾਂ ਟੋਲ ਪਲਾਜ਼ੇ ਉਹਨਾਂ ਦੇ ਵਿੱਚ ਹੀ ਸੀਗੇ ਇਸ ਕਰਕੇ ਅਸੀਂ ਤੁਹਾਨੂੰ ਵੀ ਪੁੱਛ ਰਹੇ ਹਾਂ ਅਤੇ ਡਰਾਈਵਰ ਵਧੀਆ ਘੱਲਿਓ ਜੀ ਕਿਉਂਕਿ ਫੈਮਲੀ ਆ ਨਾਲ ਪਰਿਵਾਰ ਆ ਪੂਰਾ ਬੱਚੇ ਨੇ ਹੈ ਨਾ ਲੇਡੀਜ਼ ਨੇ ਵੀ ਸਾਨੂੰ ਕੋਈ ਤੰਗ ਕਰਨ ਵਾਲਾ ਡਰਾਈਵਰ ਨਾ ਹੋਵੇ ਪੂ ਪਰ ਜੋ ਵੀ ਉੱਥੇ ਹੈ ਨਾ ਦੇਖਣ ਵਾਲੀਆ ਚੀਜ਼ਾਂ ਨੇ ਹੈ ਨਾ ਹਿਮਾਚਲ ਦੇ ਵਿੱਚ ਉਹ ਸਾਨੂੰ ਘੁਮਾ ਕੇ ਲੈ ਕੇ ਆਵੇ ਦਿਖਾ ਕੇ ਲੈ ਕੇ ਆਵੇ ਸਾਰਾ ਕੁਛ ਅਤੇ ਇਸ ਕਰਕੇ ਨਾ ਹਾਂ ਜੋ ਤੁਹਾਡੀ ਪੇਮੈਂਟ ਆ ਜੀ ਸਾਈ ਵਗੈਰਾ ਉਹ ਮੈਂ ਤੁਹਾਨੂੰ ਗੂਗਲ ਪੇ ਕਰ ਦਿੰਦਾ ਅਤੇ ਪਰਸੋਂ ਤੱਕ ਆਪਾਂ ਨੂੰ ਗੱਡੀ ਸੁਬਹਾ ਸੱਤ ਵਜੇ ਆਪਣੇ ਗੇਟ 'ਤੇ ਆ ਜਾਣੀ ਚਾਹੀਦੀ ਹੈ ਠੀਕ ਹੈ ਸਰ ਧੰਨਵਾਦ ਜੀ